ਹੈਲੋ ਹਾਂਜੀ ਅਮਰਜੀਤ ਜੀ ਕਿਆ ਹਾਲ ਚਾਲ ਹੈ ਬਸ ਵਧੀਆ ਹੋਰ ਘਰ ਬਾਰ ਸਭ ਠੀਕ ਠਾਕ ਬੱਚੇ ਬਾਬੇ ਚਲੋ ਚਲੋ ਬਾਬਾ ਦੀ ਕਿਰਪਾ ਚਾਹੀਦੀ ਹੈ ਅੱਛਾ ਮੇਰੀ ਇੱਕ ਗੱਲ ਸਰ ਮੇਰੀ ਬੇਨਤੀ ਹੈ ਤੁਹਾਨੂੰ ਅੱਛਾ ਅੱਛਾ ਕੱਲ੍ਹ ਨਾ ਐਕਚੂਅਲੀ ਮੇਰੀ ਪੇਪਰਾਂ 'ਚ ਡਿਊਟੀ ਲੱਗੀ ਹੈ ਤੁਹਾਨੂੰ ਪਤਾ ਹੀ ਹੈ ਫਿਜ਼ੀ ਉਹਦੇ ਮਾਰਕਿੰਗ ਵਾਸਤੇ ਨਾ ਹਾਂ ਹਾਂ ਅਤੇ ਕੱਲ੍ਹ ਕੱਲ੍ਹ ਦਾ ਮੇਰਾ ਇੱਕ ਦਿਨ ਐਡਜਸਟ ਕਰ ਦਿਉ ਕਿਉਂ ਮੈਨੂੰ ਕੁਛ ਐਮਰਜੈਂਸੀ ਹੈ ਠੀਕ ਹੈ ਹਾਂ ਹਾਂ ਹਾਂ ਹਾਂ ਹਾਂ ਹਾਂ ਨਹੀਂ ਹੋਰ ਕੋਈ ਨਹੀਂ ਹੈ ਸਭ ਕੁਝ ਉਹੀ ਹੈ ਨੋਰਮਲ ਜਿਹੜਾ ਚੱਲ ਰਿਹਾ ਪਹਿਲਾਂ ਹੀ ਕੋਈ ਚੇਂਜਿਜ਼ ਨਹੀਂ ਹੈ ਉਹਦੇ 'ਚ ਠੀਕ ਹੈ ਤੁਸੀਂ ਕੱਲ੍ਹ ਦਾ ਦਿਨ ਦੇਖ ਲਿਉ ਅਤੇ ਹੋ ਸਕਦਾ ਮੈਂ ਦੁਪਹਿਰ ਤੱਕ ਆ ਵੀ ਜਾਵਾਂ ਠੀਕ ਹੈ ਅਗਰ ਆ ਗਿਆ ਠੀਕ ਹੈ

ਨਹੀਂ ਨਹੀਂ ਨਹੀਂ ਤੁਸੀਂ ਉੱਥੇ ਹੀ ਰੱਖ ਦੇਣਾ ਮੇਰੇ ਟੇਬਲ 'ਤੇ ਅਤੇ ਮੈਂ ਆਪਣੇ ਆਪ ਬ ਡੇਅ ਆਫ਼ਟਰ ਟੋਮੋਰੋ ਆ ਕੇ ਜਮ੍ਹਾਂ ਪਰਸੋਂ ਜਮ੍ਹਾਂ ਕਰਾ ਦੇਊਂਗਾ ਇੰਚਾਰਜ ਜਗਜੀਤ ਸਿੰਘ ਹੈ ਉੱਥੇ ਠੀਕ ਹੈ ਹਾਂ ਤੁਸੀਂ ਉੱਥੇ ਸਾਈਨ ਕੁਛ ਨਹੀਂ ਕਰਨੇ ਨੀਚੇ ਹਾਂ ਜਿੱਦਾਂ ਤੁਸੀਂ ਹਾਂ ਮਾਰਕਿੰਗ ਕਰਕੇ ਟੋਟਲ ਕਰਕੇ ਵੈਸੇ ਰੱਖ ਦੇਣੇ ਹੈ ਮੈਂ ਆਪਣੇ ਆਪ ਸਾਈਨ ਕਰਕੇ ਪਰਸੋਂ ਜਮ੍ਹਾਂ ਕਰਾ ਦੇਊਂਗਾ ਠੀਕ ਹੈ ਜੀ ਓਕੇ ਜੀ ਧੰਨਵਾਦ